ਚਿੱਤਰਕਾਰੀ ਕਰਨਾ ਮੈਨੂੰ ਬਹੁਤ ਪਸੰਦ ਹੈ ਚਿੱਤਰਕਾਰੀ ਕਰਨ ਲਈ ਮੈਂ ਏ ਫੋਰ ਸ਼ੀਟ ਪੈਂਸਿਲ ਕਲਰ ਸਕੈਚਸ ਅਤੇ ਵਾਟਰ ਕਲਰ ਦਾ ਪ੍ਰਯੋਗ ਕਰਦਾ ਹਾਂ ਕਦੇ ਕਦੇ ਮੈਂ ਕਰਿਓਸ ਕਲਰਸ ਵੀ ਵਰਤ ਲੈਂਦਾ ਹਾਂ ਮੈਨੂੰ ਮੇਰਾ ਪਸੰਦੀਦਾ ਬ੍ਰਾਂਡ ਚਿੱਤਰਕਾਰੀ ਕਰਨ ਲਈ ਡੋਮਸ ਹੈ ਇਹ ਬ੍ਰਾਂਡ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਇਸ ਦੇ ਪ੍ਰੋਡਕਟ ਬਹੁਤ ਚੰਗੇ ਹੁੰਦੇ ਹਨ ਅਤੇ ਬਹੁਤ ਸਮੇਂ ਦੇਈ ਕੱਢ ਜਾਂਦੇ ਹਨ ਇਹ ਬ੍ਰੈਂਡ ਨੂੰ ਮੈਂ ਜ਼ਿਆਦਾਤਰ ਐਮਾਜੋਨ ਤੋਂ ਹੀ ਖਰੀਦਦਾ ਹਾਂ ਮੈਂ ਇਸ ਨੂੰ ਔਨਲਾਈਨ ਹੀ ਖਰੀਦਦਾ ਹਾਂ ਅਤੇ ਔਨਲਾਈਨ ਹੀ ਪੇਮੈਂਟ ਕਰਦਾ ਹਾਂ ਇਹ ਬ੍ਰੈਂਡ ਮੇਰੇ ਘਰ ਤੱਕ ਸਰਵਿਸ ਪਹੁੰਚਾ ਦਿੰਦਾ ਪਹੁੰਚਾ ਦਿੰਦਾ ਹੈ ਸਟੇਸ਼ਨਰੀ ਦਾ ਸਮਾਨ ਮਹਿੰਗਾ ਹੈ ਇਹ ਮੈਂ ਨਹੀਂ ਮੰਨਦਾ ਕਿਉਂਕਿ ਕਲਾ ਲਈ ਕੁਛ ਵੀ ਚੀਜ਼ ਮਹਿੰਗਾ ਨਹੀਂ ਹੁੰਦਾ ਇਹ ਸਭ ਆਪਾਂ ਨੂੰ ਸ਼ੌਕ ਹੁੰਦਾ ਹੈ ਤਾਂ ਆਪਾਂ ਕੋਈ ਵੀ ਚੀਜ਼ ਖਰੀਦ ਸਕਦੇ ਹਾਂ ਨਹੀਂ ਇਹ ਕੋਈ ਸਮਾਨ ਇੰਨਾ ਵੀ ਨਹੀਂ ਮਹਿੰਗਾ ਹੁੰਦਾ ਇਸ ਤੋਂ ਵੀ ਮਹਿੰਗੇ ਬ੍ਰੈਂਡ ਪਏ ਹਨ ਅਤੇ ਮਹਿੰਗੀਆਂ ਚੀਜ਼ਾਂ ਪਈਆਂ ਹਨ ਪਰ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਆਪਾਂ ਇਸ ਨੂੰ ਨਹੀਂ ਕਹਿ ਸਕਦੇ ਵੀ ਸਟੇਸ਼ਨਰੀ ਦਾ ਸਮਾਨ ਮਹਿੰਗਾ ਹੁੰਦਾ ਹੈ